ਹਾਂਜੀ ਹਾਂਜੀ ਹਾਂਜੀ ਅੱਛਾ ਹਾਂਜੀ ਹਾਂਜੀ ਦਿੱਤੀ ਸੀਗੀ ਕੰਮ ਤਾਂ ਹੋ ਗਿਆ ਮਤਲਬ ਥੋੜ੍ਹਾ ਬਹੁਤ ਰਹਿੰਦਾ ਜੀ ਪੈਂਡਿੰਗ ਤੁਸੀਂ ਕੀ ਕੁਛ ਆਪਣਾ ਅੱਛਾ ਅੱਛਾ ਹਾਂਜੀ ਹਾਂਜੀ ਉਹਦੀ ਨਾ ਮਤਲਬ ਜਿਹੜੇ ਮੇਨ ਹੈਡਲਾਈਟ ਆ ਉਹ ਖਰਾਬ ਆ ਗਈਆਂ ਉਹ ਨਾ ਬਾਹਰ ਭੇਜਿਆ ਹੋਇਆ ਚੰਡੀਗੜ੍ਹ ਭੇਜਿਆ ਬੰਦਾ ਅਤੇ ਉਹ ਲੈ ਕੇ ਆ ਜੂ ਅੱਜ ਸ਼ਾਮ ਤੱਕ ਜੀ ਅਤੇ ਬਾਕੀ ਏ ਸੀ ਦਾ ਕੀ ਅੰਦਰੋਂ ਨਾ ਸਾਰਾ ਕੰਮ ਹੋਣ ਵਾਲਾ ਹੈਗਾ ਉਹ ਚੈੱਕ ਕੀਤਾ ਖੋਲ ਕੇ ਮੰਪਰ ਖੋਲਣਾ ਪੈਣਾ ਉਹਦਾ ਸ ਮੂਹਰੋਂ ਮਤਲਬ ਡੈਸ਼ਬੋਰਡ ਜਿਹੜਾ ਹੁੰਦਾ ਨਾ ਉਹ ਸਾਰਾ ਖੋਲਣਾ ਪੈਣਾ ਆਪਾਂ ਨੂੰ ਅਤੇ ਉਹ ਉਹ ਖੋਲ ਦੇਦੀਏ ਆਪਾਂ ਜੀ ਫਿਰ ਹੈ ਨਾ ਇਹ ਕਿਵੇਂ ਕਰੀਏ ਦੱਸੋ ਤੁਸੀਂ ਉਹਦਾ ਖਰਚਾ ਵੱਧ ਆ ਜਾਊਗਾ ਜੀ ਖਰਚਾ ਤਾਂ ਦਸ ਹਜ਼ਾਰ ਆ ਜੂਗਾ ਦਸ ਹਜ਼ਾਰ ਦਾ ਖਰਚਾ ਆਊਗਾ ਜੀ ਉਹਦਾ ਹਾਂਜੀ ਹਾਂਜੀ ਹਾਂ ਹਾਂ ਉਹ ਤਾਂ ਹਾਂਜੀ ਉਹ ਸਾਰਾ ਸਮਾਨ ਨਵਾਂ ਪੈ ਜੂਗਾ ਜੀ ਵਿੱਚ ਹਾਂਜੀ ਕੰਪਨੀ ਦਾ ਤਾਂ ਐਂ ਆ ਵੀ ਜੇ ਮਤਲਬ ਬਾਹਰੋਂ ਕੰਪਨੀ ਦਾ ਤਾਂ ਨਹੀਂ ਹੋਊਗਾ ਮਤਲਬ ਵੀ ਉਹਦੇ ਵਰਗਾ ਹੀ ਹੁੰਦਾ ਹੈਗਾ ਮਤਲਬ ਥੋੜ੍ਹਾ ਬਹੁਤ ਕੋਪੀ ਹੁੰਦਾ ਲੇਕਿਨ ਹੁੰਦੀ ਚੀਜ਼ ਉਹ ਹੀ ਹੈ ਸੇਮ ਹੀ ਹਾਂਜੀ ਹਾਂਜੀ ਵਧੀਆ ਵਧੀਆ ਪੂਰਾ ਵਧੀਆ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਬਾਕੀ ਜੇ ਦਿੱਕਤ ਆਈ ਤਾਂ ਆਪਾਂ ਬੈਠੇ ਹਾਂ ਫਿਰ ਦੁਬਾਰਾ ਕਰਦਾਂਗੇ ਸਹੀ ਆਪਾਂ ਉਹਦੀ ਸਾਲ ਦੀ ਗਰੰਟੀ ਹੁੰਦੀ ਹੈ ਨਹੀਂ ਨਹੀਂ ਸਾਲ ਦੀ ਗਰੰਟੀ ਇਹਦੀ ਸਾਲ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਗਈ ਇਹਦੇ ਹੁੰਦਾ ਤਾਂ ਆਪਾਂ ਉਹਨੂੰ ਸਹੀ ਕਰ ਦਾਂਗੇ ਬਾਕੀ ਕੋਈ ਗੱਲ ਨਹੀਂ ਬਾਕੀ ਕੋਈ ਵੀ ਪ੍ਰੋਬਲਮ ਹੋਈ ਤਾਂ ਆਪਾਂ ਬੈਠੇ ਹਾਂ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਸਭ ਸੈੱਟ ਹੂੰ ਹੂੰ ਹੂੰ ਸੀਟ ਥੱਲੇ ਥੱਲੇ ਕਿਵੇਂ ਮਤਲਬ ਪਿੱਛੋਂ ਕਹਿ ਰਹੇ ਹੋ ਜਾਂ ਕਿ ਨੀਚੇ ਅੱਛਾ ਅੱਛਾ ਉਹ ਨੀਚੇ ਨਾ ਲੋ ਲੌਕ ਖ਼ਰਾਬ ਹੋਣਗੇ ਉਹਦੇ ਹਾਂ ਉਹ ਲੌਕ ਦੇਖਣੇ ਪੈਣਗੇ ਵੀ ਲੌਕ ਆਪਾਂ ਨਵੇਂ ਪਾ ਦੇਈਏ ਜਾਂ ਉਹ ਹੀ ਰਿਪੇਅਰ ਕਰ ਦੇਈਏ ਪਰ ਮੈਨੂੰ ਲਗਦਾ ਨਵਾਂ ਹੀ ਪਊਗਾ ਲੌਕ ਤਾਂ ਹੂੰ ਹਾਂਜੀ ਹਾਂਜੀ ਹੈੱਡਲਈਟਾਂ ਦਾ ਜੀ ਅੱਜ ਹਾਂਜੀ ਹਾਂਜੀ ਉਹ ਤਾਂ ਮੰਗਵਾਏ ਹੋਏ ਨੇ ਚੰਡੀਗੜ੍ਹ ਤੋਂ ਤਾਂ ਆ ਜਾਊਗਾ ਏ ਸੀ ਦੀ ਗੈਸ ਤਾਂ ਹੈਗੀ ਹੈ ਅੰਦਰ ਨਾ ਮਤਲਬ ਗੰਦ ਬਹੁਤ ਫਸਿਆ ਪਿਆ ਮਤਲਬ ਨਾ ਬਲੋਕ ਹੋਈ ਪਈ ਹੈ ਜਿੱਥੋਂ ਉਹ ਆਉਂਦੀ ਨਾ ਕੂਲਿੰਗ ਉਹਦੇ ਵਿੱਚ ਬਹੁਤ ਹਾਂ ਹਾਂ ਉਹ ਮਿੱਟੀ 'ਚ ਚੱਲੀ ਆ ਉਹਦੇ ਵਿੱਚ ਰੇਤਾਂ ਬਹੁਤ ਫਸਿਆ ਪਿਆ ਬਾਕੀ ਉਹ ਬਾਕੀ ਪਤਾ ਨਿਗਾ ਨਾ ਹੋਰ ਚੀਜ਼ ਵੀ ਕੀ ਪਤਾ ਕੋਈ ਲੀਰ ਵਗੈਰਾ ਫਸ ਗਈ ਹੋਵੇ ਤਾਂ ਕੋਈ ਪਤਾ ਵੀ ਨਹੀਂ ਲੱਗਦਾ ਬੱਚੇ ਆਪਣੇ ਸ਼ਰਾਰਤੀ ਹੁੰਦੇ ਆ ਕੀ ਪਤਾ ਉਹਨਾਂ ਨੇ ਹੀ ਪਾ ਤੀ ਹੋਵੇ ਵਿੱਚ ਹੂੰ ਹਾਂਜੀ ਹਾਂਜੀ ਬਸ ਤੁਸੀਂ ਐਂ ਕਰੋ ਵੋਸ਼ਿੰਗ ਉੱਥੇ ਨਾਲ ਹੀ ਕਰਾਦਾਂਗੇ ਆਪਣੇ ਨਾਲ ਹੀ ਹੈਗਾ ਸਰਵਿਸ ਸੈਂਟਰ ਉੱਥੇ ਹੀ ਕਰਵਾਦਾਂਗੇ ਬਾ ਜਮਾਂ ਨਵੀਂ ਐਨ ਪੂਰੀ ਨਵੀਂ ਬਣਾ ਕੇ ਦੇਵਾਂਗੇ ਤੁਹਾਨੂੰ ਕਾਰ ਪੂਰੀ ਵਧੀਆ ਹੂੰ ਬਸ ਐਂ ਕਰੋ ਬਸ ਸ਼ਾਮ ਨੂੰ ਆ ਜਾਊਗਾ ਏ ਸੀ ਦਾ ਆਪਾਂ ਕੰਮ ਸਟਾਰਟ ਕਰ ਦਿੰਦੇ ਹਾਂ ਚਲੋ ਫਿਰ ਐਂ ਕਰੋ ਕੱਲ੍ਹ ਸੁਬਹ ਲੈ ਜਾਇਓ ਤੁਸੀਂ ਸੁਬਹਾ ਲੈ ਜਾਇਓ ਦਸ ਗਿਆਰਾਂ ਵਜੇ ਤੁਸੀਂ ਕੋਈ ਨਹੀਂ ਕਰ ਲਾਂਗੇ ਸੈਟਿੰਗ ਆਪਾਂ ਪੰਦਰਾਂ ਤੋਂ ਵੀ ਘੱਟ ਹੀ ਕਰ ਦਾਂਗੇ ਆਪਾਂ ਕੋਈ ਗੱਲ ਹੀ ਨਹੀਂ ਹਾਂਜੀ ਚਲ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ ਓਕੇ ਜੀ